ਹੈਲੋ ਕਿਵੇਂ ਆ ਤੂੰ ਮੈਂ ਵੀ ਵਧੀਆ ਤੂੰ ਦੱਸ ਕਿਆ ਹਾਲ ਚਾਲ ਮੈਂ ਤਾਂ ਵਧੀਆ ਹਾਂ ਮੈਨੂੰ ਪਤਾ ਸੀਗਾ ਤੂੰ ਮੇਰੇ ਤੋਂ ਮਦਦ ਮੰਗੀ ਸੀਗੀ ਨਾ ਤੂੰ ਲੁਧਿਆਣੇ ਗਿਆ ਹੋਇਆ ਹੈ ਹਾਂ ਮੈਂ ਵੀ ਉੱਥੇ ਰਹਿ ਕੇ ਆਇਆ ਸੀ ਅਤੇ ਮੈਨੂੰ ਵੀ ਪਤਾ ਹੈ ਉੱਥੇ ਬਾਰੇ ਤੂੰ ਮੇਰੇ ਤੋਂ ਮਦਦ ਮੰਗੀ ਸੀ ਕਿ ਵੀ ਮੈਨੂੰ ਉੱਥੇ ਦੀਆਂ ਮਤਲਬ ਉੱਥੇ ਦੀਆਂ ਜੋ ਵੀ ਬੀਮਾ ਵਗੈਰਾ ਉਹ ਕੰਪਨੀਜ਼ ਹੈ ਜੋ ਵੀ ਹੈ ਉੱਥੇ ਦਾ ਸਾਰੀਆਂ ਮਤਲਬ ਪ੍ਰੀਮੀਅਮਸ ਵਗੈਰਾ ਹੈ ਤੂੰ ਮੈਨੂੰ ਸਾਰਿਆਂ ਬਾਰੇ ਨੈਟਵਰਕਸ ਬਾਰੇ ਪੋਲਿਸੀਸ ਬਾਰੇ ਹਸਪਤਾਲਾਂ ਬਾਰੇ ਮੈਨੂੰ ਮਾੜਾ ਜਿਹਾ ਸਮਝਾ ਦਈਂ ਅਤੇ ਮੈਂ ਤੈਨੂੰ ਇਹ ਸਮਝਾਉਣ ਦੇ ਲਈ ਮਤਲਬ ਤੈਨੂੰ ਫੋਨ ਕੀਤਾ ਹੈ ਅਤੇ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਉੱਥੇ ਦਾ ਜਿਹੜਾ ਮਤਲਬ ਮੈਂ ਤੇਰੀ ਲੋਕੇਸ਼ਨ ਵੀ ਦੇਖੀ ਸੀਗੀ ਤੂੰ ਮੈਨੂੰ ਦੱਸੀ ਸੀ ਜਿਹੜੀ ਉਹਦੇ ਮਤਲਬ ਅਨੁਸਾਰ ਹੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਜਿਹੜਾ ਬੀਮਾ ਵਾਲਾ ਮੈਂ ਤੁਹਾਨੂੰ ਭੇਜਿਆ ਹੋਇਆ ਹੈ ਉਹ ਵਾਲਾ ਬੀਮੇ ਵਾਲਿਆਂ ਵਧੀਆ ਬੀਮਾ ਕਰਦੇ ਨੇ ਉਹਨਾਂ ਦੀ ਕੋਲ ਤੂੰ ਜਾ ਸਕਦਾ ਹੈ ਉਹ ਵਧੀਆ ਨੇ ਕਿਉਂਕਿ ਮੈਂ ਉਹਨਾਂ ਨੂੰ ਆਪਣੇ ਕਿਉਂਕਿ ਮੇਰੇ ਵੀ ਰਿਸ਼ਤੇਦਾਰ ਉੱਥੇ ਰਹਿੰਦੇ ਨੇ ਮੈਂ ਉਹਨਾਂ ਨੂੰ ਵੀ ਪੁੱਛਿਆ ਸੀ ਉਹ ਕਹਿੰਦੇ ਬਹੁਤ ਵਧੀਆ ਨੇ ਅਤੇ ਹੋਰ ਤੂੰ ਨੈਟਵਰਕਸ ਨੈਟਵਰਕਸ ਊ ਸੂ ਮਤਲਬ ਜਿਹੜਾ ਏਰੀਆ ਹੈ ਉਹਦਾ ਵੀ ਵਧੀਆ ਹੈ ਜੇ ਤੂੰ ਉਹ ਉਹ ਨੈਟਵਰਕ ਲਏਗਾ ਤਾਂ ਵਧੀਆ ਹੈ ਕਿਉਂਕਿ ਰੇਂਜ ਰੂੰਜ ਵੀ ਵਧੀਆ ਆਉਂਦੀ ਹੈ ਇਸ ਲਈ ਵਧੀਆ ਹੀ ਹੈ ਉਹ ਵੀ ਕਿਉਂਕਿ ਮੈਂ ਪ ਮਤਲਬ ਉਹਨਾਂ ਨੂੰ ਪ ਪਰਸਨਲੀ ਫੋਨ ਕਰਕੇ ਪੁੱਛਿਆ ਸੀ ਉਹ ਕਹਿੰਦੇ ਵਧੀਆ ਹੈ ਅਤੇ ਹਸਪਤਾਲਾਂ ਬਾਰੇ ਵੀ ਤੂੰ ਪੁੱਛਿਆ ਸੀ ਕਿਹੜਾ ਵਧੀਆ ਕਿਆ ਨਹੀਂ ਹੈ ਕਿਆ ਜੋ ਵੀ ਹੈ ਹੈ ਨਾ ਕਿੱਥੇ ਵਧੀਆ ਖ਼ਰਚਾ ਖ਼ੁਰਚਾ ਘੱਟ ਵੱਧ ਆ ਮਤਲਬ ਸਹੀ ਵੀ ਹੋਵੇ ਮਤਲਬ ਸਰਵਿਸ ਵੀ ਵਧੀਆ ਹੋਵੇ ਅਤੇ ਉਹਦੇ ਬਾਰੇ ਵੀ ਮੈਂ ਤੈਨੂੰ ਭੇਜਿਆ ਹੋਇਆ ਜਿਹਦੀ ਫੋਟੋ ਹੈ ਨਾ ਉਹ ਤੂੰ ਇੱਕ ਵਾਰ ਦੇਖ ਲਈ ਮੈਨੂੰ ਤਾਂ ਵਧੀਆ ਲੱਗਿਆ ਅਤੇ ਉੱਥੇ ਮਤਲਬ ਹੋਸਪਿਟਲ ਡਾਕਟਰਸ ਵਗੈਰਾ ਵੀ ਵਧੀਆ ਨੇ ਕਾਫੀ ਮੈਂ ਮਤਲਬ ਚੈੱਕ ਕੀਤੇ ਆ ਹੁਣ ਸਰਚ ਕਰਕੇ ਬਹੁਤ ਵਧੀਆ ਨੇ ਤੂੰ ਤੂੰ ਦੇਖ ਲਈ ਠੀਕ ਹੈ ਮੈਂ ਤਾਂ ਤੈਨੂੰ ਇਹੀ ਦੱਸਣਾ ਚਾਹੁੰਦੀ ਹਾਂ ਆਹੀਂ ਮੈਂ ਤੈਨੂੰ ਸਿਹਤ ਜੋ ਵੀਰੇ ਸਿਹਤ ਸੂਤ ਬਾਰੇ ਜਿਹੜੀਆਂ ਤੂੰ ਮੈਨੂੰ ਆਹ ਜ ਦੋ ਤਿੰਨ ਚੀਜ਼ਾਂ ਦੇਖਣ ਲਈ ਭੇਜ ਕਹੀਆਂ ਸੀ ਕਿ ਦੇਖ ਕੇ ਮੈਨੂੰ ਪਤਾ ਕਰਕੇ ਦੱਸੀ ਵੀ ਜਿਹੜੀਆਂ ਜਿਹੜੀਆਂ ਵਧੀਆ ਆਏ ਮੈਨੂੰ ਤਾਂ ਆਹੀ ਚੀਜ਼ਾਂ ਵਧੀਆ ਲੱਗੀਆਂ ਅਤੇ ਮੈਂ ਤੈਨੂੰ ਦੱਸ ਰਹੀ ਹਾਂ ਅਤੇ ਜੇ ਤੇਰੀ ਚੀਜ਼ ਮਦਦ ਕਰੇ ਤਾਂ ਮੈਨੂੰ ਬਹੁਤ ਖੁਸ਼ੀ ਹੋਏਗੀ